ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਦੱਸਿਆ ਗਿਆ ਹੈ ਕਿ ਪੇਂਡੂ ਖੇਤਰਾਂ ਵਿੱਚ ਸਰਕਾਰੀ ਸ਼ਾਸਨ ਦੀ ਕਈ ਕਾਰਨਾਂ ਕਾਰਨ ਘੱਟ ਹੋ ਸਕਦੀ ਹੈ ਜਿਵੇਂ ਕਿ ਇੱਥੇ ਜਨਤਕ ਸੇਵਾਵਾਂ ਮਾੜੀਆਂ ਹੁੰਦੀਆਂ ਹਨ ਪੇਂਡੂ ਖੇਤਰਾਂ ਵਿੱਚ ਮੈਡੀਕਲ ਫੈਸਿਲਿਟੀ ਬਹੁਤ ਘੱਟ ਹੁੰਦੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੇਂਡੂ ਲੋਕਾਂ ਨੂੰ ਸ਼ਹਿਰਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਆਉਣਾ ਪੈਂਦਾ ਹੈ ਇਸ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰੀ ਸਾਨੂੰ ਇਲਾਜ ਪ੍ਰੋਪਰ ਟਾਈਮ ਸਿਰ ਚਾਹੀਦਾ ਹੁੰਦਾ ਹੈ ਪਰ ਪੇਂਡੂ ਲੋਕਾਂ ਨੂੰ ਪਿੰਡ ਵਿੱਚ ਰਹਿਣ ਕਰਕੇ ਇਲਾਜ ਪੂਰੇ ਸਮੇਂ ਸਿਰ ਨਹੀਂ ਮਿਲ ਪਾਉਂਦਾ ਕਈ ਵਾਰ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਇੱਕ ਤਾਂ ਉਹਨਾਂ ਦਾ ਕਾਰਨ ਇਹ ਹੈ ਤਾਂ ਦੂਸਰਾ ਇਹ ਹੈ ਕਿ ਉੱਥੇ ਸਿਹਤ ਅਸਮਾਨਤਾਵਾਂ ਵੀ ਵਾਧੂ ਹਨ ਕਿਉਂਕਿ ਪੇਂਡੂ ਲੋਕਾਂ ਨੂੰ ਪ੍ਰੋਪਰ ਰਹਿਣ ਸਹਿਣ ਦੀ ਸੁਵਿਧਾ ਨਹੀਂ ਮਿਲਦੀ ਉਹਨਾਂ ਦੇ ਘਰ ਖੁੱਲ੍ਹੇ ਹੁੰਦੇ ਹਨ ਜੋ ਅਤੇ ਉਹਨਾਂ ਦੇ ਘਰਾਂ ਦੇ ਬਾਹਰ ਪਾਣੀ ਜੰਮਿਆ ਹੁੰਦਾ ਜਿਸ ਕਰਕੇ ਮੱਛਰ ਵਗੈਰਾ ਆ ਜਾਂਦੇ ਹਨ ਅਤੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਕਈ ਬਿਮਾਰੀਆਂ ਹੋ ਜਾਂਦੀਆਂ ਹਨ ਬਾਕੀ ਪੇਂਡੂ ਵਾਤਾਵਰਨ ਤਾਂ ਸਾਰਿਆਂ ਨਾਲੋਂ ਚੰਗਾ ਹੁੰਦਾ ਹੈ ਪਿੰਡ ਦੇ ਲੋਕ ਚੰਗੇ ਵਾਤਾਵਰਨ ਵਿੱਚ ਰਹਿੰਦੇ ਹਨ ਅਤੇ ਆਪਣੀ ਸਿਹਤ ਨੂੰ ਚੰਗਾ ਬਣਾਉਂਦੇ ਹਨ ਪੇਂਡੂ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਚੰਗੀ ਤੋਂ ਚੰਗੀ ਦੇਣੀ ਸਰਕਾਰ ਦਾ ਫਰਜ਼ ਹੈ ਧੰਨਵਾਦ